ਟੈਕਨੋਲਜੀ ਜਿੱਥੇ ਸਾਡੇ ਲਈ ਬਹੁਤ ਲਾਹੇਵੰਦ ਹੈ ਉੱਥੇ ਹੀ ਬਜ਼ੁਰਗਾਂ ਨੂੰ ਟੈਕਨੋਲਜੀ ਦੀ ਵਰਤੋਂ ਕਰਦਿਆਂ ਕੁਛ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜਿਹੜੀ ਪ੍ਰਮੁੱਖ ਚੁਣੌਤੀ ਟੈਕਨੋਲਜੀ ਦੀ ਵਰਤੋਂ ਕਰਦਿਆਂ ਬਜ਼ੁਰਗਾਂ ਨੂੰ ਆਉਂਦੀ ਹੈ ਉਹ ਹੈ ਕਿ ਫਰੋਡ ਬਹੁਤ ਦੇਖੇ ਜਾਂਦੇ ਨੇ ਇੱਕ ਤੁਹਾਨੂੰ ਕਾਲ ਆਉਂਦੀ ਹੈ ਉਹਦੇ ਵਿੱਚ ਉਹ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਇੰਨਾ ਕੈਸ਼ ਜਿੱਤ ਗਏ ਓਂ ਤੁਹਾਨੂੰ ਲਾਟਰੀ ਨਿਕਲੀ ਹੈ ਅਤੇ ਉਹ ਕਹਿ ਦਿੰਦੇ ਨੇ ਕਿ ਤੁਹਾਨੂੰ ਓਟੀਪੀ ਆਏਗਾ ਇੱਕ ਅਤੇ ਉਹ ਜਦੋਂ ਕੋਈ ਬਜ਼ੁਰਗ ਉਹਦੇ ਝਾਂਸੇ 'ਚ ਆ ਕੇ ਓਟੀਪੀ ਦੱਸ ਦਿੰਦਾ ਹੈ ਅਤੇ ਉਹਦੇ ਬੈਂਕ ਦੇ ਅਕਾਊਂਟ 'ਚ ਸਾਰੇ ਪੈਸੇ ਉੜ ਜਾਂਦੇ ਨੇ ਇਸ ਤੋਂ ਇਲਾਵਾ ਦੂਜੀ ਸਮੱਸਿਆ ਇਹ ਹੈ ਕਿ ਮੋਬਾਇਲਾਂ ਵਿੱਚ ਜਾਂ ਸੋਫਟਵੇਅਰ ਐਵੇਂ ਦੇ ਨੇ ਇੰਨੇ ਮਤਲਬ ਕੰਪਲੈਕਸ ਨੇ ਗੁੰਝਲਦਾਰ ਨੇ ਉਹ ਬਜ਼ੁਰਗਾਂ ਦੇ ਸਮਝ ਵਿੱਚ ਨਹੀਂ ਆਉਂਦੇ ਉਹਦਾ ਇੰਟਰਫੇਸ ਐਵੇਂ ਦਾ ਹੁੰਦਾ ਹੈ ਕਿ ਉਹਨੂੰ ਸਮਝਣ ਵਿੱਚ ਦਿੱਕਤ ਮਹਿਸੂਸ ਹੁੰਦੀ ਹੈ ਇਹ ਤੋਂ ਇਲਾਵਾ ਇਹ ਵੀ ਹੈ ਕਿ ਕੋ ਕਿਸੇ ਬਜ਼ੁਰਗ ਦਾ ਕੋਈ ਨੰਬਰ ਹੈ ਉਸ ਉੱਤੇ ਕੋਈ ਫੇਕ ਆਈਡੀ ਵੀ ਬਣਾ ਸਕਦਾ ਅਤੇ ਬਜ਼ੁਰਗਾਂ ਨੂੰ ਓਟੀਪੀ ਵਗੈਰਾ ਦਾ ਪਤਾ ਨਹੀਂ ਹੁੰਦਾ ਅਤੇ ਉਹ ਉਹਦੀ ਅਡੈਂਟਿਟੀ ਦੀ ਦੁਰਵਰਤੋਂ ਵੀ ਕਰ ਸਕਦੇ ਨੇ ਐਵੇਂ ਤੁਹਾਨੂੰ ਚਾਹੀਦਾ ਹੈ ਕਿ ਬਜ਼ੁਰਗਾਂ ਨੂੰ ਘੱਟੋ ਘੱਟ ਐਵੇਂ ਦੀਆਂ ਗੱਲਾਂ ਦੱਸੀਏ ਜਿਹਦੇ ਨਾਲ ਉਹ ਹੈਕਿੰਗ ਤੋਂ ਜਾਂ ਇਹੋ ਜਿਹੇ ਫਰੋਡਾਂ ਤੋਂ ਬਚ ਸਕਣ ਅਸੀਂ ਉਨ੍ਹਾਂ ਨੂੰ ਦੱਸ ਸਕਦੇ ਹਾਂ ਕਿ ਜੇਕਰ ਐਵੇਂ ਦਾ ਕੌਲ ਆਵੇ ਕੋਈ ਤਾਂ ਅਸੀਂ ਓਟੀਪੀ ਦੱਸਣਾ ਨਹੀਂ ਹੈਗਾ ਅਤੇ ਕਿਸੇ ਗੈਰ ਬੰਦੇ ਨੂੰ ਫੋਨ ਫੜਾਣਾ ਹੀ ਨਹੀਂ ਹੈਗਾ ਇਹ ਤਰੀਕੇ ਨੇ ਜਿਹੜੇ ਜਿਹਦੇ ਨਾਲ ਅਸੀਂ ਟੈਕਨੋਲਜੀ ਦੀ ਵਰਤੋਂ ਚੰਗੇ ਤਰੀਕੇ ਨਾਲ ਕਰ ਸਕਦੇ ਹਾਂ ਜਿਹੜੀਆਂ ਚੁਣੌਤੀਆਂ ਨੇ ਉਹਦਾ ਸਾਮਣਾ ਇਹ ਤਰੀਕੇ ਨਾਲ ਕੀਤਾ ਜਾ ਸਕਦਾ